ਖ਼ਬਰਾਂ ਵਿੱਚ ਜੋ ਦਿਖਾਇਆ ਜਾਂਦਾ ਹੈ ਅਤੇ ਅਸਲੀਅਤ ਵਿੱਚ ਕੀ ਹੋ ਰਿਹਾ ਹੈ ਵਿੱਚ ਅੰਤਰ ਮਹੱਤਵਪੂਰਨ ਰੱਖਦਾ ਹੈ ਖ਼ਬਰਾਂ ਆਉਟਲੈਟ ਵਧੇਰੇ ਸੂਖਮ ਜਾਂ ਦੁਨਿਆਵੀ ਕਹਾਣੀਆਂ ਨਾਲੋਂ ਸੰਸਕੇਜੀ ਧਿਆਨ ਖਿੱਚਣ ਵਾਲੀਆਂ ਕਹਾਣੀਆਂ ਨੂੰ ਤਰਜੀਹ ਦਿੰਦੀ ਹੈ ਖ਼ਬਰਾਂ ਸੰਘਰਸ਼ ਡਰਾਮੇ ਅਤੇ ਨਕਾਰਾਤਮਕ ਘਟਨਾਵਾਂ 'ਤੇ ਧਿਆਨ ਕੇਂਦਰਿਤ ਕਰਦੀਆਂ ਹਨ ਅਸਲੀਅਤ ਦੀ ਇੱਕ ਤਿੱਖੀ ਧਾਰਨਾ ਬਣਾਉਣ ਦੀ ਕੋਸ਼ਿਸ਼ ਕਰਦੀਆਂ ਹਨ ਕੁਝ ਖ਼ਬਰਾਂ ਮਹੱਤਵਪੂਰਨ ਸੁੰਦਰ ਭਾਵ ਜਾਂ ਵੇਰਵਿਆਂ ਨੂੰ ਛੱਡ ਸਕਦੀਆਂ ਹਨ ਜਿਸ ਨਾਲ ਘਟਨਾਵਾਂ ਦੀ ਅਧੂਰੀ ਸਮਝ ਹੋ ਸਕਦੀ ਹੈ ਖ਼ਬਰਾਂ ਅਕਸਰ ਮੂਲ ਕਾਰਨ ਦੀ ਬਜਾਏ ਲੱਛਣ 'ਤੇ ਕੇਂਦਰਿਤ ਹੁੰਦੀਆਂ ਹਨ ਅਸਲ ਸੰਸਾਰ ਦੇ ਮੁੱਦੇ ਸੂਖਮ ਹੁੰਦੇ ਹਨ ਅਤੇ ਗੁੰਝਲਦਾਰ ਹੁੰਦੇ ਹਨ ਜਦੋਂ ਕਿ ਖ਼ਬਰਾਂ ਇਹਨਾਂ ਨੂੰ ਸਰਲ ਅਤੇ ਸਪੱਸ਼ਟ ਰੂਪ ਵਿੱਚ ਪੇਸ਼ ਕਰਦੇ ਹਨ ਇੱਕ ਜਾਅਲੀ ਖ਼ਬਰ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਹਾਂ ਕਿ ਜਿਵੇਂ ਕਿ ਹੁਣ ਰੂਸ ਅਤੇ ਯੂਕਰੇਨ ਦੇਸ਼ਾਂ ਦਾ ਯੁੱਧ ਚੱਲ ਰਿਹਾ ਹੈ ਇਸ ਮੁੱਦੇ ਨੂੰ ਹੀ ਕੁਝ ਖ਼ਬਰਾਂ ਦੇ ਚੈਨਲ ਨੇ ਆਪਣੀ ਚੈਨਲ ਦੀ ਟੀ ਆਰ ਪੀ ਵਧਾਉਣ ਲਈ ਖ਼ਬਰ ਬਣਾਈ ਕਿ ਅਮੈਰੀਕਾ ਵੀ ਕੈਨੇਡਾ ਦੇਸ਼ ਨਾਲ ਯੁੱਧ ਦੀ ਤਿਆਰੀ ਕਰ ਰਿਹਾ ਹੈ ਇਹ ਜਾਅਲੀ ਖ਼ਬਰ ਆਪਣੇ ਚੈਨਲ ਦੀ ਟੀ ਆਰ ਪੀ ਲਈ ਲੋਕਾਂ ਨੂੰ ਗੁਮਰਾਹ ਕਰਦੀਆਂ ਹਨ ਇਸ ਨਾਲ ਲੋਕ ਗਲਤ ਧਾਰਨਾ ਬਣਾਉਂਦੇ ਹਨ ਇਹ ਹੀ ਫਿਰ ਉਹ ਅਗਲੇ ਆਪਣੇ ਸਾਥੀਆਂ ਨਾਲ ਸ਼ੇਅਰ ਕਰਦੇ ਹਨ ਜਿਸ ਨਾਲ ਇਹ ਮੁੱਦਾ ਲੋਕਲ ਟਾਈਪ ਤੇ ਗੰਭੀਰ ਬਣ ਜਾਂਦਾ ਹੈ ਅਤੇ ਲੋਕ ਗੁਮਰਾਹ ਹੋ ਜਾਂਦੇ ਹਨ